ਹੈਲੋ ਹਾਂਜੀ ਤੁਸੀਂ ਸਟੂਡੀਓ ਤੋਂ ਗੱਲ ਕਰ ਰਹੇ ਹੋ ਫੋਟੋਗ੍ਰਾਫਿੰਗ ਦੀ ਹਾਂਜੀ ਮੈਂ ਨਾ ਇੱਕ ਮਾਡਲ ਫੋਟੋ ਸ਼ੂਟ ਕਰਵਾਣਾ ਸੀ ਫੋਟੋ ਸ਼ੂਟ ਹਾਂਜੀ ਮੈਨੂੰ ਨਾ ਦੂਜੇ ਐਂਡ ਦੇ ਸਾਨੂੰ ਸਲਾਹ ਚਾਹੀਦੀ ਸੀ ਤੇ ਸਾਨੂੰ ਪਹਿਲਾਂ ਏਰੀਆ ਵਧੀਆ ਲੱਭੇਗਾ ਤੇ ਤਿਥੇ ਬਹੁਤ ਵਧੀਆ ਫੋਟੋ ਸ਼ੂਟ ਹੋ ਸਕਦਾ ਹਾਂਜੀ ਨਮੈਨ ਦੇ ਬਾਰੇ ਥੋੜਾ ਜਿਹਾ ਦੱਸੋਗੇ ਹਾਂਜੀ ਹਾਂਜੀ ਹਾਂਜੀ ਹਾਂਜੀ ਤੇ ਮੈਨੂੰ ਆਹ ਫੋਟੋ ਸ਼ੂਟਿੰਗ ਚ ਤੇ ਬਲਰ ਫੋਟੋ ਨਾ ਆਵੇ ਤੇ ਬਹੁਤ ਵਧੀਆ ਕੁਆਲਿਟੀ ਦਾ ਤੁਹਾਡਾ ਕੈਮਰਾ ਹੋਣਾ ਚਾਹੀਦਾ ਹਾਂਜੀ ਮੈਮ ਤੇ ਮੈਮ ਸਾਨੂੰ ਇਨਦੇ ਹਾਂਜੀ ਮੈਮ ਇਨਦੇ ਰੇਟ ਕੀ ਹੋਣਗੇ ਪੂਰੀ ਫੋਟੋਗ੍ਰਾਫੀ ਦੇ ਹਾਂਜੀ ਤੇ ਹਾਂਜੀ ਮੈਮ ਤੇ ਹੋਰ ਕੁਝ ਨਵਾਂ ਫੋਨ ਸੇਵਾਵਾਂ ਹਾਂਜੀ ਹਾਂਜੀ ਹਾਂਜੀ ਮੈਮ ਮੈਂ ਤਾਂ ਇਦਾਂ ਚਾਹੁੰਦੀ ਆ ਜਿਵੇਂ ਬੀਚ ਹੋਵੇ ਵਿੱਚੇ ਸਨਸੈਟ ਹੋਵੇ ਹਾਂਜੀ ਮੈਮ ਉਹਦੇ ਰਿਲੇਟਿਵ ਥੋੜਾ ਜਿਹਾ ਆਈਡੀਆ ਦੇ ਦੋ ਕੀ ਚਾਰਜ ਹੋਣਗੇ ਕੀ ਪੈਸੇ ਅਦਿ ਦਾ ਤੇ ਮੈਮ ਡੇਜ਼ ਵਗੈਰਾ ਵੀ ਕਿੰਨੇ ਦਿਨਾਂ ਚ ਤੁਸੀਂ ਪੂਰਾ ਕੰਮ ਕਰ ਸਕਦੇ ਹੋ ਫੋਟੋ ਸ਼ੂਟ ਦਾ ਹਾਂਜੀ ਮੈਮ ਜਿਵੇਂ ਅਲੱਗ ਅਲੱਗ ਸ਼ਹਿਰ ਤੇ ਵਧੀਆ ਵਧੀਆ ਜਿਵੇਂ ਸਾਰੇ ਆਪਾਂ ਵਧੀਆ ਚੀਜ਼ਾਂ ਦੇ ਲਈਏ ਤਾਂ ਫੋਟੋਸ਼ੂਟ ਵਗੈਰਾ ਮੇਰੀ ਉਥੇ ਮੋਡਲਿੰਗ ਦਾ ਤੇ ਉਹਦੇ ਚਾਰਜਿਸ ਵਗੈਰਾ ਰੈਂਟ ਵਗੈਰਾ ਤੇ ਉਹਦੇ ਖਰਚੇ ਸਾਨੂੰ ਪੇ ਕਰਨੇ ਪੈਣਗੇ ਤੁਹਾਡੇ ਰਹਿਣ ਦਾ ਵੀ ਸਾਰਾ ਹਾਂਜੀ ਹਾਂਜੀ ਤੇ ਤੁਸੀਂ ਕੋਈ ਡਿਸਕਾਊਂਟ ਦੋਏਗੇ ਫੋਟੋਗ੍ਰਾਫੀ ਵਿੱਚ ਠੀਕ ਹੈ ਮੈਮ ਥੈਂਕਯੂ ਸੋ ਮੱਚ